ਮੈਂ ਜਿਹੜਾ ਇਹ ਮੋਬਾਇਲ ਇਸ ਸਾਈਟ ਤੋਂ ਮੰਗਵਾਇਆ ਏ ਇਹ ਮੋਬਾਇਲ ਬਿਲਕੁਲ ਰੱਦੀ ਹੈ ਨਾ ਇਹਦਾ ਕੀਪੈਡ ਚੱਲਦਾ ਹੈ ਨਾ ਇਹਦੀ ਰੈਮ ਚਲਦੀ ਹੈ ਨਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਟੋਰੇਜ ਹੈ ਬਿਲਕੁਲ ਰੱਦੀ ਕਿਸਮ ਦਾ ਮਾਲ ਮੈਨੂੰ ਭੇਜਿਆ ਗਿਆ ਹੈ ਮੇਰਾ ਐਕਸਪੀਰੀਐਂਸ ਇਸ ਮੋਬਾਇਲ ਦੇ ਮਾਮਲੇ ਵਿੱਚ ਬਿਲਕੁਲ ਜ਼ੀਰੋ ਹੈ ਮੈਂ ਆਪਣੇ ਆਪ ਨੂੰ ਇਹ ਮੋਬਾਇਲ ਨਾਲ ਜੋੜ ਕੇ ਬਿਲਕੁਲ ਠੱਗਿਆ ਹੋਇਆ ਮਹਿਸੂਸ ਕਰਦਾ ਹਾਂ ਮੈਨੂੰ ਇਹ ਮੋਬਾਇਲ ਨਹੀਂ ਲੋੜੀਂਦਾ ਮੈਂ ਕੰਪਨੀ ਨੂੰ ਇਹ ਮੋਬਾਇਲ ਵਾਪਿਸ ਭੇਜ ਦੇਣਾ ਹੈ ਉਸ ਕੰਪਨੀ ਨੂੰ ਵੀ ਮੈਂ ਇਹ ਸ਼ਿਕਾਇਤ ਕਰਾਂਗਾ ਕਿ ਇਸ ਤਰ੍ਹਾਂ ਦੇ ਮੋਬਾਇਲ ਜੇਕਰ ਭੇਜਣੇ ਹਨ ਤਾਂ ਕਿਰਪਾ ਕਰਕੇ ਨਾਲ ਇਹ ਲਿਖ ਦਿਓ ਕਿ ਅਸੀਂ ਇੱਦਾਂ ਦੇ ਕੰਪ ਮੋਬਾਇਲ ਭੇਜਣ ਤੋਂ ਬਾਅਦ ਤੁਹਾਡੀ ਸ਼ਿਕਾਇਤ ਨਹੀਂ ਸੁਣਾਂਗੇ ਸੋ ਅਸੀਂ ਇੱਦਾਂ ਦੇ ਮੋਬਾਇਲ ਨੂੰ ਆਰਡਰ ਹੀ ਨਹੀਂ ਕਰਾਂਗੇ ਮੇਰਾ ਐਕਸਪੀਰੀਐਂਸ ਇਸ ਮੋਬਾਇਲ ਦੇ ਪ੍ਰਤੀ ਬਹੁਤ ਗੰਦਾ ਰਿਹਾ ਹੈ ਮੈਂ ਇੱਦਾਂ ਦਾ ਮੋਬਾਇਲ ਦੁਬਾਰਾ ਕਦੇ ਵੀ ਆਰਡਰ ਨਹੀਂ ਕਰਾਂਗਾ